ਹਾਂਜੀ ਤੁਸੀਂ ਫਲਿੱਪਕਾਰਟ ਤੋਂ ਬੋਲ ਰਹੇ ਹੋ ਮੈਂ ਕਰੋਕਰੀ ਦਾ ਸਮਾਨ ਮੰਗਾਇਆ ਸੀ ਬਹੁਤ ਵਧੀਆ ਲੱਗਿਆ ਮੈਨੂੰ ਉਹਦੀ ਡਿਜ਼ਾਈਨਿੰਗ ਬਹੁਤ ਵਧੀਆ ਸੀਗੀ ਅਤੇ ਪੈਕਿੰਗ ਬਹੁਤ ਵਧੀਆ ਸੀਗੀ ਅਤੇ ਮੈਨੂੰ ਬਹੁਤ ਵਧੀਆ ਲੱਗਿਆ